ਸਤਿ ਸ਼੍ਰੀ ਅਕਾਲ ਜੀ ਮੈਂ ਛੋਟੇ ਹੁੰਦਿਆਂ ਜਦੋਂ ਸਕੂਲ ਜਾਂ ਫਿਰ ਕਾਲਜ ਵਿੱਚ ਲੱਗੀ ਹੋਈ ਸੀ ਮੈਂ ਬਹੁਤ ਵਾਰੀ ਸਕੂਲ ਦੇ ਫੰਕਸ਼ਨਾਂ ਅਤੇ ਕਾਲਜ ਦੇ ਫੰਕਸ਼ਨਾਂ ਵਿੱਚ ਹਿੱਸਾ ਵੀ ਲਿਆ ਸੀ ਅਤੇ ਬਹੁਤ ਸਾਰੇ ਫੰਕਸ਼ਨ ਦੇਖੇ ਵੀ ਸਨ ਸਕੂਲ ਵਿੱਚ ਕੋਈ ਨਾ ਕੋਈ ਫੰਕਸ਼ਨ ਹੁੰਦਾ ਹੀ ਰਹਿੰਦਾ ਹੈ ਜਿਵੇਂ ਕਿ ਚਿਲਡਰਨਸ ਡੇ ਟੀਚਰਸ ਡੇ ਛੱਬੀ ਜਨਵਰੀ ਪੰਦਰ੍ਹਾਂ ਅਗਸਤ ਤੀਆਂ ਦਾ ਤਿਉਹਾਰ ਲੋਹੜੀ ਵਿਸਾਖੀ ਆਦਿ ਜਾਂ ਫਿਰ ਹੋਰ ਵੀ ਸਲਾਨਾ ਸਮਾਗਮ ਕੀਤੇ ਜਾਂਦੇ ਹਨ ਛੱਬੀ ਜਨਵਰੀ ਬਾਰੇ ਜਿਵੇਂ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਦੁਆਰਾ ਲਿਖਿਆ ਗਿਆ ਸੀ ਪੰਦਰ੍ਹਾਂ ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਜਿਵੇਂ ਸਾਡੇ ਦੇਸ਼ ਦੇ ਕਿਵੇਂ ਸਾਡੇ ਦੇਸ਼ ਨੂੰ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਜੋ ਪਹਿਲਾਂ ਅੰਗਰੇਜ਼ਾਂ ਦਾ ਗੁਲਾਮ ਸੀ ਜਦੋਂ ਅਸੀਂ ਸਕੂਲ ਦੇ ਛੋਟੇ ਛੋਟੇ ਫੰਕਸ਼ਨਾਂ ਵਿੱਚ ਹਿੱਸਾ ਲੈਂਦੇ ਹਾਂ ਜਾਂ ਤਾਂ ਸਾਡੇ ਵਿੱਚ ਇੱਕ ਕੋਨਫੀਡੈਂਸ ਦੀ ਭਾਵਨਾ ਪੈਦਾ ਹੁੰਦੀ ਹੈ ਜਦੋਂ ਅਸੀਂ ਸਟੇਜ 'ਤੇ ਚੜ੍ਹ ਕੇ ਕਿਸੇ ਪੰਜਾਹ ਬੱਚਿਆਂ ਦੇ ਸਾਹਮਣੇ ਬੋਲਣ ਜਾਂਦੇ ਹਾਂ ਤਾਂ ਸਾਨੂੰ ਥੋੜ੍ਹੀ ਜਿਹੀ ਨਰਵਸ ਮਹਿਸੂਸ ਹੁੰਦੀ ਹੈ ਪਰ ਜਦੋਂ ਅਸੀਂ ਸਟੇਜ 'ਤੇ ਪਹੁੰਚ ਜਾਦੇ ਹਾਂ ਤਾਂ ਉਹ ਜਦੋਂ ਸਾਡਾ ਕਲੈਪਿੰਗ ਨਾਲ ਸਾਰੇ ਜਣੇ ਸਵਾਗਤ ਕਰਦੇ ਹਨ ਤਾਂ ਸਾਡੇ ਵਿੱਚ ਕੋਨਫੀਡੈਂਸ ਦੀ ਭਾਵਨਾ ਆ ਜਾਂਦੀ ਹੈ ਜਦੋਂ ਸਾਡੇ ਵਿੱਚ ਕੋਨਫੀਡੈਂਸ ਦੀ ਭਾਵਨਾ ਆ ਗਈ ਕੋਨਫੀਡੈਂਸ ਦੀ ਭਾਵਨਾ ਸਾਡੇ ਅੱਗੇ ਅੱਗੇ ਵਾਲੀ ਲਾਈਫ ਵਿੱਚ ਵੀ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ ਜਦੋਂ ਸਾਡੇ ਵਿੱਚ ਕੋਨਫੀਡੈਂਸ ਹੋਵੇਗਾ ਤਾਂ ਅਸੀਂ ਕਿਸੇ ਅੱਗੇ ਆਪਣੀ ਗੱਲ ਵਧੀਆ ਤਰੀਕੇ ਨਾਲ ਪੇਸ਼ ਕਰ ਸਕਾਂਗੇ ਸਕੂਲਾਂ ਦੇ ਫੰਕਸ਼ਨਾਂ ਵਿੱਚ ਬੱਚੇ ਜਦੋਂ ਵੱਖ ਵੱਖ ਐਕਟੀਵਿਟੀਜ਼ ਵਿੱਚ ਭਾਗ ਲੈਂਦੇ ਹਨ ਤਾਂ ਉਹਨਾਂ ਦੇ ਵੱਖ ਵੱਖ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ ਜੋ ਉਹਨਾਂ ਨੂੰ ਹੋਰਨਾਂ ਨਾਲੋ ਅਲੱਗ ਕਰਦੇ ਹਨ ਉਹਨਾਂ ਦੇ ਵੱਖਰੇ ਵੱਖਰੇ ਗੁਣ ਦੇਖ ਕੇ ਅਧਿਆਪਕ ਵੀ ਉਹਨਾਂ ਨੂੰ ਉਹਨਾਂ ਦੇ ਉਹਨਾਂ ਗੁਣਾਂ ਲਈ ਉਹਨਾਂ ਨੂੰ ਪ੍ਰੇਰਿਤ ਕਰ ਸਕਦਾ ਹੈ ਵੀ ਤੁਸੀਂ ਇਸ ਸਟ੍ਰੀਮ 'ਚ ਜਾ ਸਕਦੇ ਹੋ ਜ਼ਰੂਰੀ ਨਹੀਂ ਕਿ ਹਰ ਬੱਚਾ ਪੜ੍ਹਾਈ ਵਿੱਚ ਹੀ ਇੰਟੈਲੀਜੈਂਟ ਹੋਵੇ ਉਹ ਹੋਰ ਵੀ ਬਹੁਤ ਸਾਰੇ ਕੰਮਾਂ ਵਿੱਚ ਇੰਟੈਲੀਜੈਂਟ ਹੋ ਸਕਦਾ ਹੈ ਜਿਵੇਂ ਸਪੋਰਟਸ ਵਿੱਚ ਹੋ ਗਿਆ ਡਾਂਸਿੰਗ ਵਿੱਚ ਹੋ ਗਿਆ ਕੁਛ ਹੋਰ ਗੇਮਸ ਵਿੱਚ ਹੋ ਗਿਆ ਜੋ ਉਹ ਆਪਣੇ ਇਹਨਾਂ ਹੁਨਰਾ ਨਾਲ ਬੜਾ ਜੇ ਉਹ ਜੋ ਸਟੂਡੈਂਟ ਪੜ੍ਹਾਈ ਵਿੱਚ ਵੀ ਬਹੁਤ ਇੰਟੈਲੀਜੈਂਟ ਹਨ ਉਹਨਾਂ ਦੇ ਬਰਾਬਰ ਖੜ੍ਹ ਸਕਦੇ ਹਨ ਸੋ ਸਕੂਲ ਦੇ ਫੰਕਸ਼ਨਾਂ ਵਿੱਚ ਹਿੱਸਾ ਲੈਣ ਅਤੇ ਸਕੂਲ ਦੇ ਫੰਕਸ਼ਨਾਂ ਨੂੰ ਦੇਖਣ ਤੋਂ ਬਾਅਦ ਮੇਰਾ ਇਹੀ ਤਜ਼ਰਬਾ ਹੋ ਸਕਦਾ ਹੈ ਕਿ ਸਾਨੂੰ ਸਕੂਲ ਦੇ ਫੰਕਸ਼ਨਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਉਹ ਹਰ ਚੀਜ਼ ਚ ਪਾਰਟੀਸਪੇਟ ਕਰੇ ਪਾਰਟੀਸਪੇਟ ਜ਼ਰੂਰੀ ਨਹੀਂ ਹੁੰਦਾ ਕਿ ਪਾਰਟੀ ਅਸੀਂ ਜਿੱਤ ਜਾਂ ਹਾਰ ਲਈ ਹੀ ਕਰ ਸਕਦੇ ਕਿਸੇ ਚੀਜ਼ ਗੇਮ ਵਿੱਚ ਪਾਰਟੀਸਪੇਟ ਕਰਨਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਨਾਲ ਬੱਚਿਆਂ ਵਿੱਚ ਵਧੀਆ ਭਾਵਨਾਵਾਂ ਪੈਦਾ ਹੁੰਦੀਆਂ ਹਨ ਜਿਵੇਂ ਉਹ ਇੱਕ ਦੂਜੇ ਨਾਲ ਬੋਲ ਚਾਲਦੇ ਹਨ ਇੱਕ ਦੂਜੇ ਦੀਆਂ ਗੁਣਾਂ ਬਾਰੇ ਪਤਾ ਲੱਗਦਾ ਹੈ ਜੋ ਚੰਗੇ ਗੁਣ ਉਹ ਆਪਣੇ ਵਿੱਚ ਲਿਆ ਵੀ ਸਕਦੇ ਹਨ ਕੁਝ ਮਾੜੀਆਂ ਆਦਤਾਂ ਛੱਡ ਵੀ ਸਕਦੇ ਹਨ ਉਹ ਇਕੱਠੇ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਇਸ ਲਈ ਸਾਨੂੰ ਇਹੀ ਸੋਚਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਸਕੂਲ ਜਾਂ ਕਾਲਜ ਵਿੱਚ ਫੰਕਸ਼ਨ ਕਰਵਾਇਆ ਜਾਵੇ ਮੇਨਲੀ ਉਹਨਾ ਦਾ ਟੋਪਿਕ ਜੋ ਹੈ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਮਝਾਇਆ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਕਿ ਉਹ ਵੱਧ ਤੋਂ ਵੱਧ ਹਿੱਸਾ ਲੈਣ ਜਿਹਨਾਂ ਕਰਕੇ ਉਹਨਾਂ ਵਿੱਚ ਕੋਨਫੀਡੈਂਸ ਦੀ ਭਾਵਨਾ ਆਵੇ ਜੇ ਬੰਦੇ ਵਿੱਚ ਕੋਨਫੀਡੈਂਸ ਹੁੰਦਾ ਹੈ ਤਾਂ ਉਹ ਕੁਛ ਵੀ ਕਰ ਸਕਦਾ ਹੈ ਧੰਨਵਾਦ